ਹੁਸ਼ਿਆਰਪੁਰ ਤੋਂ ਗੱਲ ਕਰ ਰਹੇ ਹਾਂਜੀ ਮੇਰਾ ਨਾਮ ਨਿਤਿਸ਼ ਆ ਅਤੇ ਮੈਂ ਇੱਥੇ ਹੁਸ਼ਿਆਰਪੁਰ ਦੇ ਵਿੱਚ ਐਡਮਿਸ਼ਨ ਲਈ ਹੈ ਮੇਰਾ ਫਸਟ ਈਅਰ ਆ ਅਤੇ ਐਕਚੂਲੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੀ ਕਿ ਹੁਸ਼ਿਆਰਪੁਰ ਦੇ ਵਿੱਚ ਕਲਾਈਮੇਟ ਕਿਸ ਤਰ੍ਹਾਂ ਦਾ ਮਤਲਬ ਵੈਦਰ ਕਿੱਦਾਂ ਦਾ ਰਹਿੰਦਾ ਮੈਂ ਉਸ ਹਿਸਾਬ ਨਾਲ ਮਤਲਬ ਆਪਣੇ ਕੱਪੜੇ ਵਗੈਰਾ ਦੀ ਸ਼ੋਪਿੰਗ ਕਰਾਂਗੇ ਉਸ ਹਿਸਾਬ ਨਾਲ ਮੈਂ ਆਪਣੇ ਕੋਲ ਸਮਾਨ ਰੱਖਾਂ ਠੀਕ

ਇੱਕ ਮੈਂ ਇੱਕ ਕੁਐਰੀ ਕਰ ਰਿਹਾ ਸੀ ਕਿ ਮੈਂ ਆਪਣਾ ਇੱਥੇ ਹੋਸਟਲ ਰੂਮ ਸੈਟਅਪ ਕਰਨਾ ਸੀ ਅਤੇ ਗਰਮੀਆਂ ਦੇ ਵਿੱਚ ਏਅਰ ਕੰਡੀਸ਼ਨ ਦੀ ਲੋੜ ਪੈਂਦੀ ਹੈ ਕਿ ਨਹੀਂ ਓਕੇ ਓਕੇ ਅਤੇ ਜਦੋਂ ਮਾਨਸੂਨ ਸੀਜ਼ਨ ਆਉਂਦਾ ਓਦੋਂ ਕੋਈ ਮਤਲਬ ਫਲੱਡ ਵਗੈਰਾ ਆਉਣ ਦੀ ਕੋਈ ਉਹ ਤਾਂ ਨਹੀਂ ਆ ਦਿੱਕਤ ਤਾਂ ਨਹੀਂ ਆ

ਹੋਰ ਬਸ ਇੰਨਾ ਹੀ ਪੁੱਛਣਾ ਸੀ ਮੈਂ ਕੀ ਵੈਦਰ ਬਾਰੇ ਬਾਰੀ ਤੁਸੀਂ ਦੱਸ ਹੀ ਦਿੱਤਾ ਸਾਰਾ ਕੁਛ ਮੈਂ ਕਲੀਅਰ ਹੈ ਸਾਰਾ ਕੁਛ ਥੈਂਕ ਯੂ